ਸਤਿ ਸ਼੍ਰੀ ਅਕਾਲ ਜੀ ਪਰਮਗਤਮ ਮੌਕਿਆਂ 'ਤੇ ਨੱਚਦੇ ਸਮੇਂ ਲੋਕ ਪਹਿਲਾਂ ਦੇ ਲੋਕ ਘੱਗਰਾ ਅਤੇ

ਭੰਗੜੇ ਦੇ ਮੁੰਡੇ ਹੁੰਦੇ ਸਨ ਉਹ ਸਿਰ ਉੱਤੇ ਤੁਰਲੇ ਵਾਲੀ ਪੱਗ ਚਾਦਰਾ ਕੁੜਤਾ ਅਤੇ ਗਲੇ ਵਿੱਚ ਕੈਂਠੇ ਅਤੇ ਹੱਥਾਂ ਵਿੱਚ ਖੁੰਡੇ ਫੜ ਕੇ ਨੱਚਦੇ ਸਨ ਅਤੇ ਅੱਜ ਕੱਲ੍ਹ ਦੇ ਜੋ ਡਾਂਸਰਾਂ ਨੇ ਜੋ ਓਹ ਸੂਟ ਸ਼ਰਾਰਾ ਸੂਟ ਮਤਲਬ ਕਿ ਸ਼ਰਾਰਾ ਸੂਟ ਸਲਵਾਰ ਸੂਟ ਪਾਉਂਦੀਆਂ ਨੇ ਕੰਨਾਂ ਵਿੱਚ ਬਾਲੇ ਕੰਨਾਂ ਵਿੱਚ ਲੋਟਨ ਅਤੇ ਮੱਥੇ ਉੱਤੇ ਟਿੱਕਾ ਗੁੱਤ 'ਚ ਪਰਾਂਦੀ ਪੈਰਾਂ ਵਿੱਚ ਜੁੱਤੀ ਪਾ ਕੇ ਆਪ ਅਤੇ ਡਾਂਸ ਕਰਦੀਆਂ ਹਨ ਅਤੇ ਜੋ ਪਹਿਲਾਂ ਵਾਲੇ ਸੀ ਉਹ ਪੂਰੇ ਕੱਪੜੇ ਪਾ ਕੇ ਡਾਂਸ ਕਰਦੀਆਂ ਸਨ ਅੱਜ ਕੱਲ੍ਹ ਦੀਆਂ ਡਾਂਸਰਾਂ ਅੱਧੇ ਅੱਧੇ ਕੱਪੜੇ ਪਾ ਕੇ ਡਾਂਸ ਕਰਦੀਆਂ ਹਨ